ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਤੁਸੀਂ ਪ੍ਰੀਤ ਬੋਲ ਰਹੇ ਹੋ ਮਾਨਸਾ ਤੋਂ ਮਹਾਰਾਜਾ ਕੋਲੇਜ ਮੈਮ ਮੈਂ ਖੁਸ਼ੀ ਬੋਲ ਰਹੀ ਸੀ ਲੁਧਿਆਣੇ ਤੋਂ ਮੈਂ ਰਮਨਦੀਪ ਬੋਲ ਰਹੀ ਸੋਰੀ ਮੈਮ ਨਿੱਕ ਨੇਮ ਦੱਸ ਬੈਠੀ ਅਤੇ ਮੈਂ ਤੁਹਾਡੇ ਕੋਲੇਜ ਬਾਰੇ ਪਤਾ ਕਰਨਾ ਸੀ ਮੈਂ ਨਿਊ ਅਡਮੀਸ਼ਨ ਕਰਵਾਈ ਹੈ ਇੱਥੇ ਹਾਂਜੀ ਕੋਲੇਜ ਬਾਰੇ ਪਤਾ ਕਰਨਾ ਸੀ ਹਾਂਜੀ ਹਾਂਜੀ ਨਿਊ ਸਟੂਡੈਂਟ ਇਸ ਵਾਰੀ ਹਾਂਜੀ ਹਾਂਜੀ ਹਾਂਜੀ ਅਤੇ ਮੈਂ ਪੁੱਛਣਾ ਸੀ ਵੀ ਇੱਦਾਂ ਦਾ ਇੱਥੋਂ ਦਾ ਸਟਾਫ ਵਗੈਰਾ ਕਿਵੇਂ ਹੈ ਜੀ ਸਟੂਡੈਂਟ ਵਗੈਰਾ ਟੀਚਰ ਵਗੈਰਾ ਮੈਮ ਮੈਂ ਇੱਥੇ ਹੀ ਰਹਾਂਗੀ ਵੈਦਰ ਵਗੈਰਾ ਬਾਰੇ ਪੁੱਛਣਾ ਸੀ ਜੀ

ਪਾਣੀ ਵਗੈਰਾ ਲਾਈਟ ਵਗੈਰਾ ਦਾ ਬਾਰਿਸ਼ ਵਗੈਰਾ ਮਤਲਬ ਕਿਵੇਂ ਬਿਲਕੁਲ ਹਾਂਜੀ ਹਾਂਜੀ ਅਤੇ ਔਰ ਬਾਰਿਸ਼ ਵਗੈਰਾ ਇੱਥੇ ਜ਼ਿਆਦਾ ਤਾਂ ਨਹੀਂ ਆਉਂਦੀ ਓ ਓਕੇ ਔਰ ਮੈਮ ਮਤਲਬ ਟੀਚਰਸ ਵਗੈਰਾ ਸਟੂਡੈਂਟ ਵਗੈਰਾ ਵਧੀਆ ਓਕੇ ਮੈਮ ਓਕੇ

ਓਕੇ ਮੈਮ